ਮੈਂ ਸਕੂਲ ਟੈਮ 'ਤੇ ਆਪਣੀ ਕਿਤਾਬ ਵਿੱਚ ਇੱਕ ਕਹਾਣੀ ਪੜ੍ਹੀ ਸੀ ਜਿਸ ਨੇ ਜਿਸ ਤੋਂ ਮੈਂ ਕਾਫੀ ਇੰਸਪਾਇਰ ਹੋਇਆ ਸੀ ਅਤੇ ਮੈਨੂੰ ਉਸ ਨਾਲ ਆਪਣੀ ਜ਼ਿੰਦਗੀ 'ਚ ਕਾਫੀ ਕੁਛ ਕਰਨ ਨੂੰ ਮਿਲਿਆ ਜਿੱਦਾਂ ਕਿ ਉਸ ਕਹਾਣੀ ਦਾ ਨਾਂ ਸੀ ਪਿਆਸਾ ਕਾਂ ਅਤੇ ਜਿਸ ਵਿੱਚ ਇੱਕ ਕਾਂ ਨੂੰ ਬੜੀ ਪਿਆਸ ਲੱਗਦੀ ਹੈ ਅਤੇ ਉਹ ਪਾਣੀ ਦੀ ਭਾਲਵਾ ਭਾਲ ਵਿੱਚ ਇੱਧਰ ਉੱਧਰ ਘੁੰਮਦਾ ਰਹਿੰਦਾ ਹੈ ਅਤੇ ਉਸ ਨੂੰ ਕਿਤੇ ਵੀ ਪਾਣੀ ਨਹੀਂ ਮਿਲਦਾ ਉਹ ਇੱਕ ਥਾਂ ਤੋਂ ਉੱਡ ਕੇ ਦੂਜੀ ਥਾਂ ਜਾਂਦਾ ਦੂਜੀ ਥਾਂ ਤੋਂ ਤੀਜੀ ਥਾਂ ਜਾਂਦਾ ਹੈ ਉਹਨੂੰ ਕਿਤੇ ਵੀ ਪਾਣੀ ਨਹੀਂ ਮਿਲਦਾ ਹੈ ਅਤੇ ਉਸਨੂੰ ਪਿਆਸ ਹੀ ਬੜੀ ਲੱਗੀ ਹੁੰਦੀ ਹੈ ਅਤੇ ਅਚਾਨਕ ਹੀ ਉਸਦੀ ਨਜ਼ਰ ਇੱਕ ਮਟਕੇ ਵਿੱਚ ਪੈਂਦੀ ਹੈ ਅਤੇ ਜਿਸ ਵਿੱਚ ਥੋੜ੍ਹਾ ਜਿਹਾ ਪਾਣੀ ਹੁੰਦਾ ਹੈ ਅਤੇ ਜਦ ਉਹ ਆਪਣੀ ਚੁੰਝ ਉਸ ਮਟਕੇ ਦੇ ਵਿੱਚ ਪਾਣੀ ਪੀਣ ਲਈ ਪਾਂਦਾ ਹੈ ਤਾਂ ਉਹ ਚੁੰਝ ਪਾਣੀ ਤੱਕ ਨਹੀਂ ਪੋਚ ਪੁੱਜ ਸਕਦੀ ਜਿਸ ਨਾਲ ਉਹਨੂੰ ਬੜਾ ਦੁੱਖ ਲੱਗਦਾ ਹੈ ਪਰ ਉਹ ਹਿੰਮਤ ਨਹੀਂ ਹਾਰਦਾ ਅਤੇ ਉਹ ਛੋਟੇ ਛੋਟੇ ਜਿਹੜੇ ਆਸ ਪਾਸ ਕੰਕਰ ਪਏ ਹੁੰਦੇ ਹੈ ਉਹ ਲਿਆ ਕੇ ਉਹ ਕੰਕਰ ਵਿੱਚ ਪਾਉਣੇ ਸਟਾਰਟ ਕਰ ਦਿੰਦਾ ਹੈ ਅਤੇ ਹੌਲੀ ਹੌਲੀ ਇਕ ਥੋ ਥੋੜ੍ਹੇ ਥੋੜ੍ਹੇ ਕੰਕਰ ਪਾ ਕੇ ਪਾਣੀ ਦਾ ਲੇਵਲ ਉੱਪਰ ਆਉਣ ਲੱਗਦਾ ਹੈ ਤੇ ਹੌਲੀ ਹੌਲੀ ਹੌਲੀ ਹੌਲੀ ਕਰਕੇ ਪਾਣੀ ਦਾ ਲੇਵਲ ਉੱਪਰ ਆ ਜਾਂਦਾ ਹੈ ਅਤੇ ਉਹ ਜਦ ਪਾਣੀ ਦਾ ਲੇਵਲ ਉੱਪਰ ਆ ਜਾਂਦਾ ਹੈ ਤਾਂ ਉਹ ਫਿਰ ਕਾਂ ਉਸ ਮਟਕੇ 'ਚੋਂ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਦਿੰਦਾ ਹੈ ਅਤੇ ਫਿਰ ਉੱਥੋਂ ਚਲਾ ਜਾਂਦਾ ਹੈ ਅਤੇ ਇਸ ਕਹਾਣੀ ਤੋਂ ਸਾਨੂੰ ਕਾਫੀ ਕੁਛ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਮਤਲਬ ਆਪਣੇ ਆਪ ਤੋਂ ਜੋ ਵੀ ਹੈ ਐਫਰਟ ਕਰਕੇ ਜੋ ਵੀ ਅਸੀਂ ਸੋਚਿਆ ਹੈ ਉਸਨੂੰ ਮੁਕੰਮਲ ਕਰਨਾ ਚਾਹੀਦਾ ਹੈ